ਚੋਣਾਂ ਲੋਕਤੰਤਰ ਦਾ ਇੱਕ ਅਭਿੰਨ ਅੰਗ ਹੈਗਾ ਚੋਣਾਂ ਤੋਂ ਹੀ ਅਸੀਂ ਆਪਣੇ ਜਨ ਪ੍ਰਤੀਨਿਧੀ ਚੁਣ ਕੇ ਸ਼ਾਸਨ ਕਰਨ ਵਾਸਤੇ ਭੇਜਦੇ ਨੇ ਪਰ ਚੌਣਾਂ ਦੇ ਦੌਰਾਨ ਆਮ ਪਬਲਿਕ ਨੂੰ ਕਈ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਦੇ ਵਿੱਚ ਇੱਕ ਜਿਹੜੀ ਵੱਡੀ ਦਿੱਕਤ ਹੈ ਜਿਹੜੀ ਅੱਜ ਕੱਲ੍ਹ ਪੌਲੀਟੀਕਲ ਪਾਰਟੀਆਂ ਆਪਣੀ ਰੈਲੀਆਂ ਕੱਢਦੀਆਂ ਨੇ ਉਹ ਹੈਗੀ ਰੈਲੀ ਦੇ ਦੌਰਾਨ ਇਹ ਆਪਣੀ ਮੋਟਰਸਾਇਕਲਾਂ ਗੱਡੀਆਂ ਲੈ ਕੇ ਸੜਕਾਂ 'ਤੇ ਲੰਬੀਆਂ ਕਤਾਰਾਂ ਲਾ ਦਿੰਦੇ ਨੇ ਜਿਸ ਦੇ ਕਰਕੇ ਆਮ ਪਬਲਿਕ ਨੂੰ ਆਉਣ ਜਾਣ ਵਾਸਤੇ ਬਹੁਤ ਹੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ